ਹੈਲੋ ਹਾਂਜੀ ਮੇਰਾ ਨਾਮ ਨੀਰੂ ਹੈ ਔਰ ਮੈਂ ਗੁਰਦਾਸਪੁਰ ਕੀ ਪੰਜਾਬ ਕੀ ਰਹਿਨੇ ਵਾਲੀ ਹੂੰ ਔਰ ਅੱਜ ਅਸੀਂ ਇੱਕ ਦੁਬਾਰਾ ਅਸੀਂ ਅਸ ਅੱਜ ਅਸੀਂ ਭੰਗੜੇ ਦੇ ਬਾਰੇ ਗੱਲ ਕਰਾਂਗੇ ਕਿ ਭੰਗੜਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਇੱਕ ਭੰਗੜਾ ਮਤਲਬ ਕਿ ਜਿਹੜਾ ਅਸੀਂ ਪਾਉਣੇ ਕਰਦੇ ਹਾਂ ਉਹਦੇ ਵਿੱਚ ਹੁੰਦਾ ਹੈ ਐਰੋਬਿਕਸ ਕਿੰਨੇ ਤਰੀਕਿਆਂ ਨਾਲ ਆਪਣੇ ਸੱਭਿਆਚਾਰਕ ਵਿਰਾਸਤ ਨੂੰ ਅਪਣਾਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ ਭੰਗੜਾ ਜਿਹੜਾ ਹੁੰਦਾ ਹੈ ਕਈ ਲੋਕ ਮੁੰਡੇ ਜਿਮ ਵਿੱਚ ਜਾਂਦੇ ਹਨ ਉੱਥੇ ਮਤਲਬ ਕਿ ਆਪਣੇ ਗ ਗਾਣੇ ਵਜਾ ਕੇ ਪੰਜਾਬੀ ਗਾਣੇ ਲਗਾ ਕੇ ਉਹ ਪਰਬ ਉਸ ਤਰ੍ਹਾਂ ਦੇ ਹੀ ਸਟੈਪ ਭੰਗੜਾ ਪਾਉਂਦੇ ਹਨ ਔਰ ਇਹਦੇ ਦੇ ਨਾਲ ਹੋਰ ਆਪਣੇ ਜਿਸ ਤਰ੍ਹਾਂ ਮਤਲਬ ਕਿ ਡਿਪਰੈਸ਼ਨ ਦੇ ਹੁੰਦੇ ਆ ਹੋਰ ਕਈ ਬਿਮਾਰੀਆਂ ਦੇ ਹੁੰਦੇ ਹੈ ਔਰ ਉਸੀ ਮਤਲਬ ਕਿ ਭੰਗੜਾ ਪਾ ਕੇ ਆਪਣੀ ਇਸ ਬਿਮਾਰੀ ਨੂੰ ਦੂਰ ਕਰਦੇ ਹਨ ਔਰ ਉਹਨਾਂ ਦਾ ਹਰ ਧਿਆਨ ਭੰਗੜੇ ਦੇ ਸਟੈਪ ਵੱਲ ਹੁੰਦਾ ਹੈ ਔਰ ਆਪਣੀ ਪੂਰੀ ਸਰੀਰ ਵੱਲ ਵੀ ਉਹਨਾਂ ਦਾ ਧਿਆਨ ਹੁੰਦਾ ਹੈ ਜਿਸ ਕਰਕੇ ਭੰਗੜੇ ਦੇ ਨਾਲ ਨਾਲ ਉਹਨਾਂ ਦੇ ਸਰੀਰ ਦੀ ਵੀ ਰਿਕਵਰੀ ਹੁੰਦੀ ਹੈ ਇਸ ਤ ਲਈ ਮਤਲਬ ਜੋ ਵੀ ਜਿਹਨੂੰ ਲੋਕ ਜਾਂਦੇ ਆ ਬੱਚੇ ਜਾਂਦੇ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉੱਥੇ ਡੈਕ ਲਗਾ ਕੇ ਗਾਣੇ ਲਗਾ ਕੇ ਪੰਜਾਬੀ ਭੰਗੜਾ ਪਾਉਂਦੇ ਹਨ ਜਿਸ ਵਿੱਚ ਉਹਨਾਂ ਦਾ ਬਹੁਤ ਹੀ ਵਧੀਆ ਮਤਲਬ ਕਿ ਉਹਨਾਂ ਦਾ ਆਪਣੇ ਸਰੀਰ ਹੋ ਜਾਂਦਾ ਹੈ ਔਰ ਇੱਕ ਦਾ ਮਤਲਬ ਕਿ ਉਹਨਾਂ ਨੂੰ ਖੁਸ਼ਹਾਲੀ ਆਉਂਦੀ ਹੈ ਜਿਸ ਵਿੱਚ ਉਹਨਾਂ ਦੇ ਮਤਲਬ ਕਿ ਦਿਮਾਗ ਮਾਇੰਡ ਜਿਹੜਾ ਉਹਨਾਂ ਦਾ ਚੇਂਜ ਹੁੰਦਾ ਹੈ ਇਸ ਭੰਗੜੇ ਦੇ ਨਾਲ ਉਹਨਾਂ ਦਾ ਮਾਇੰਡ ਚੇਂਜ ਹੋ ਜਾਂਦਾ ਹੈ ਇਸ ਲਈ ਮਤਲਬ ਕਿ ਭੰਗੜਾ ਬਹੁਤ ਹੀ ਯੋਗਦਾਨ ਐਸੀ ਹੈ ਪਾ ਸਕਦੇ ਹਾਂ ਕਿ ਮਤਲਬ ਕਿ ਸਾਨੂੰ ਉਹਨਾਂ ਦੇ ਨਾਲ ਇਸ ਜੋ ਇਸ ਭੰਗੜੇ ਦੇ ਨਾਲ ਸਾਨੂੰ ਵੀ ਉਹਨਾਂ ਦੇ ਨਾਲ ਪੂਰਾ ਮਤਲਬ ਕਿ ਅਨੰਤ ਲੈਣਾ ਚਾ ਆਨੰਦ ਲੈਣਾ ਚਾਹੁੰਦਾ ਹੈ ਕਿ ਸਾਨੂੰ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਹੀ ਮਤਲਬ ਕਿ ਯੋਗਦਾਨ ਪਾਉਣਾ ਜ਼ਿਆਦਾ ਹੈ ਕਿ ਉਹਨਾਂ ਦਾ ਜਿਹੜਾ ਮਾਇੰਡ ਹੈ ਬਿਲਕੁਲ ਹੀ ਇਕਦਮ ਚੇਂਜ ਹੋ ਜੇ ਥੈਂਕ ਯੂ ਜੀ